ਮੈਂ ਆਪਣੀ ਗਾਇਕੀ ਵਿੱਚ ਗਤੀਸ਼ੀਲਤਾ ਵਿਕਾਸ ਅਤੇ ਵਿਆਖਿਆ ਨੂੰ ਹਮੇਸ਼ਾ ਸ਼ਾਮਲ ਕਰਦਾ ਹੀ ਰਹਿੰਦਾ ਵੈਸੇ ਤਾਂ ਪਰ ਅਜੇ ਮੈਂ ਕੋਈ ਪ੍ਰੋਫੈਸ਼ਨਲ ਸਿੰਗਰ ਵੀ ਨਹੀਂ ਹੈ ਸਿੰਗਰ ਵੀ ਨਹੀਂ ਹੈਗਾ ਹੈ ਨਾ ਪਰ ਫਿਰ ਵੀ ਮੈਂ ਵਧੀਆ ਹੋਣ ਦੀ ਕੋਸ਼ਿਸ਼ ਵਿੱਚ ਲੱਗਿਆ ਹੀ ਰਹਿੰਦਾ ਅਤੇ ਹੁਣ ਹੁਣ ਵੀ ਕੁਝ ਨਾ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਵਿੱਚ ਵੀ ਕੁਝ ਨਾ ਕੁਝ ਨਵਾਂ ਸਿੱਖਦਾ ਹੀ ਰਹਾਂ ਅਤੇ ਮੈਂ ਜ਼ਿਆਦਾਤਰ ਆਪ ਹੀ ਲਿਖ ਕੇ ਆਪਣੇ ਗਾਣੇ ਗਾਉਂਦਾ ਹੁੰਦਾ ਅਤੇ ਉਹਦੇ ਵਿੱਚ ਆਪਣੀ ਮਾਂ ਬੋਲੀ ਦੀ ਆਪਣੇ ਸੱਭਿਆਚਾਰ ਦੀ ਜਾਂ ਫਿਰ ਆਪਣਾ ਆਲਾ ਦੁਆਲਾ ਕਿੱਦਾਂ ਵੀ ਕੁਝ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਮੈਂ ਅਤੇ ਗਾਇਕੀ ਕਰਦੇ ਟਾਈਮ ਮੈਂ ਹਰ ਚੀਜ਼ ਇਕੱਲੇ ਇਕੱਲੇ ਵ ਸ਼ਬਦ ਸ਼ਬਦ ਦੀ ਵਿਆਖਿਆ ਸਹੀ ਤਰੀਕੇ ਨਾਲ਼ ਕਰਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਵਿੱਚ ਹੀ ਲੱਗ ਕੋਸ਼ਿਸ਼ ਕਰਦਾ ਹੁੰਦਾ ਵੀ ਹਰੇਕ ਬੰਦੇ ਨੂੰ ਸੁਣਨ ਵਾਲੇ ਨੂੰ ਐਨ ਵਧੀਆ ਤਰੀਕੇ ਨਾਲ਼ ਸਮਝ ਆਵੇ ਅਤੇ ਉਦੂ ਬਾਅਦ 'ਚ ਹੁਣ ਮੈਂ ਅੱਗੇ ਤੋਂ ਅੱਗੇ ਮਤਲਬ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਜਿੰਨਾ ਮੇਰੇ ਤੋਂ ਵਧੀਆ ਹੋਊਗਾ ਓਨਾ ਵਧੀਆ ਕਰੂੰਗਾ ਮੈਂ ਅੱਗੇ ਵੀ ਅਤੇ ਅਜੇ ਵੀ ਮੈਂ ਸਿੱਖ ਰਿਹਾ ਬਹੁਤ ਕੁਝ ਅੱਗੇ ਅੱਗੇ ਹੋਰ ਵੀ ਸਿੱਖਣ ਨੂੰ ਮਿਲ ਰਿਹਾ ਜੋ ਵੀ ਸਿੱਖੀ ਜਾ ਰਹੇ ਹਾਂ ਅੱਗੇ ਅੱਗੇ ਹੋਰ ਵੀ ਵਧੀਆ ਕਰਾਂਗੇ